ਹੈਲੋ ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ ਉਹ ਮੈਂ ਤੁਹਾਡੇ ਲਾਗੇ ਨਵਾਂ ਆਇਆ ਹਾਂ ਕਿਰਾਏਦਾਰ ਨਾ ਸਾਡੀ ਉਹ ਗੱਲਬਾਤ ਕਰਵਾਈ ਹੋਣੀ ਹੈ ਚਾਚਾ ਜੀ ਨੇ ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਉਹ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੁਸੀਂ ਦੱਸੋ ਹਾਂਜੀ ਹਾਂਜੀ ਗੱਲ ਦੱਸੋ ਆਂਟੀ ਉਹ ਨਾ ਘਰ ਸਬਜ਼ੀ ਵਗੈਰਾ ਬਣਾਉਣੀ ਆ ਅਤੇ ਉਹ ਮੈਂ ਸਬਜ਼ੀਆਂ ਮਿਲੇ ਨਹੀਂ ਕਰਦੀ ਆ ਵਧੀਆ ਇੱਥੋਂ ਕਿਤੋਂ ਪਹਿਲਾਂ ਮੈਂ ਗਿਆ ਵੀ ਸੀ ਇੱਕ ਦੁਕਾਨ 'ਤੇ ਉੱਥੇ ਸਬਜ਼ੀਆਂ ਹੈ ਸੀ ਪਰ ਉਹ ਸਹੀ ਨਹੀਂ ਸੀ ਬਹੀਆ ਸਬਜ਼ੀਆਂ ਰੱਖੀਆਂ ਹੋਈਆਂ ਆਂਟੀ ਤਾਜ਼ੀਆਂ ਸਬਜ਼ੀਆਂ ਕਿੱਥੋਂ ਮਿਲਣ ਗੀਆਂ ਯਾਰ ਐਥੋਂ ਕਿਤੋਂ

ਹਾਂਜੀ ਆਂਟੀ ਪਰ ਉਹ ਆਂਟੀ ਆਂਟੀ ਉਹ ਮੰਟੂ ਦੀ ਦੁਕਾਨ 'ਤੇ ਨਹੀਂ ਆ ਉਹਦੀ ਦੁਕਾਨ ਬੰਦ ਸੀ ਅੱਜ ਹਾਂਜੀ ਹੋਰ ਕੋਈ ਦੁਕਾਨ ਦੱਸੋ ਜੇ ਕੋਈ ਹੈਗੀ ਲਾਗੇ ਸ਼ਾਗੇ ਜੇ ਉਹ ਛੋਟੀ ਜਿਹੀ ਦੁਕਾਨ ਹੈ ਜਿਹੜੀ ਕੋਈ ਗੱਲ ਨਹੀਂ ਆਂਟੀ ਓਕੇ ਓਕੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਉਹ ਤੋਂ ਲੈ ਕੇ ਮੈਂ ਕੋਸ਼ਿਸ਼ ਕਰਦਾ ਬਣਾਉਣ ਦੀ ਚਲੋ ਠੀਕ ਆ ਆਂਟੀ ਠੀਕ